ਸਤਿ ਸ਼੍ਰੀ ਅਕਾਲ ਸਰ ਸਰ ਮੈਂ ਦੇਸ ਰਾਜ ਬੋਲਦਾ ਹਾਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਤੁਹਾਨੂੰ ਮੈਂ ਇੱਕ ਯੋਗਾ ਬਾਰੇ ਉਦਾਹਰਨ ਦੇ ਰਿਹਾ ਹਾਂ ਮੈਂ ਇੱਕ ਛੋਟੀ ਉਮਰ ਦੇ ਵਿੱਚ ਪੰਦਰਾਂ ਤੋਂ ਸਾਲ ਦੀ ਉਮਰ ਵਿੱਚ ਯੋਗਾ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਪਰ ਸਾਨੂੰ ਜਿਹਦੇ ਨਾਲ ਕੋਈ ਸਾਨੂੰ ਕੋਈ ਬਿਮਾਰੀ ਨਾ ਲੱਗ ਸਕੇ ਇਸ ਕਰਕੇ ਸਾਨੂੰ ਸਵੇਰੇ ਔਰ ਸ਼ਾਮ ਨੂੰ ਯੋਗਾ ਕਰਨਾ ਜ਼ਰੂਰੀ ਹੈ ਇਸ ਜਿਹਦੇ ਨਾਲ ਸਾਡਾ ਸਰੀਰ ਤੰਦਰੁਸਤ ਰਹੇ ਇਸ ਕਰਕੇ ਸਾਡੇ ਸਰੀਰ ਦੀ ਪਾਚਨ ਕਿਰਿਆ ਔਰ ਜਿਹੜੀਆਂ ਹੱਡੀਆਂ ਨੇ ਮਜ਼ਬੂਤ ਰਹਿਣ ਇਸ ਕਾਰਨ ਇਸ ਯੋਗਾ ਕਰਨ ਨਾਲ ਸਾਡੀ ਪਾਚਨ ਕਿਰਿਆ ਬਿਲਕੁਲ ਸਹੀ ਰਹਿੰਦੀ ਹੈ ਇਸ ਯੋਗਾ ਕਰਨ ਦੇ ਲਈ ਸਾਨੂੰ ਕਈ ਫਾਇਦੇ ਉਠਾਏ ਜਾਂਦੇ ਹਨ ਇਸ ਯੋਗਾ ਤੋਂ ਅਸੀਂ ਅਸੀਂ ਯੋਗਾ ਕਰਨ ਨਾਲ ਸਾਨੂੰ ਸਾਡਾ ਸਰੀਰ ਬਿਲਕੁਲ ਠੀਕ ਠਾਕ ਰਹਿੰਦਾ ਹੈ ਇਸ ਯੋਗਾ ਦੇ ਹੋਰ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਇਸ ਯੋਗਾ ਦੀ ਉਮਰ ਵੱਧ ਤੋਂ ਵੱਧ ਪੰਦਰਾਂ ਸਾਲ ਅਤੇ ਹੋਣੀ ਚਾਹੀਦੀ ਹੈ